ਮੇਰੀ ਹੇਮਕੁੰਡ ਸਾਹਿਬ ਦੀ ਯਾਤਰਾ ਬਹੁਤ ਵਧੀਆ ਰਹੀ ਅਸੀਂ ਗੋਬਿੰਦ ਘਾਟ ਤੱਕ ਤਾਂ ਕਾਰਾਂ ਗੱਡੀਆਂ 'ਤੇ ਹੀ ਗਏ ਉਸ ਤੋਂ ਅੱਗੇ ਗੋਬਿੰਦ ਧਾਮ ਦੀ ਯਾਤਰਾ ਸਾਡੀ ਪੈਦਲ ਹੀ ਰਹੀ ਸਾਨੂੰ ਬਾਰ੍ਹਾਂ ਤੇਰ੍ਹਾਂ ਕਿਲੋਮੀਟਰ ਪੈਦਲ ਹੀ ਚਲਣਾ ਪਿਆ ਰਾਹ ਦੇ ਵਿੱਚ ਅਸੀਂ ਕਈ ਥਾਵਾਂ 'ਤੇ ਰੁਕੇ ਕਈ ਥਾਵਾਂ 'ਤੇ ਅਸੀਂ ਚਾਹ ਪਾਣੀ ਪੀਤਾ ਗੋਵਿੰਦ ਧਾਮ ਤੋਂ ਹੇਮਕੁੰਡ ਸਾਹਿਬ ਦੀ ਯਾਤਰਾ ਤਕਰੀਬਨ ਸੱਤ ਕਿਲੋਮੀਟਰ ਹੈ ਇਹ ਇਲਾਕਾ ਸਿੱਧਾ ਪਹਾੜੀ ਦੀ ਤਰ੍ਹਾਂ ਹੈ ਅਤੇ ਰਾਹ ਵਿੱਚ ਕਈ ਥਾਵਾਂ 'ਤੇ ਬਰਫ ਵੀ ਪਈ ਹੋਈ ਸੀ ਅਤੇ ਇੱਕ ਪਾਸੇ ਖੱਡਾਂ ਸਨ ਅਤੇ ਇੱਕ ਪਾਸੇ ਰਸਤਾ ਸੀ ਅੱਗੇ ਜਾ ਕੇ ਕਿਤੇ ਕਿਤੇ ਬਰਫੀਲਾ ਇਲਾਕਾ ਵੀ ਸੀ ਅਸੀਂ ਸਾਰੇ ਨਾਮ ਜਪਦੇ ਹੋਏ ਚਲੇ ਜਾ ਰਹੇ ਰਸਤੇ ਵਿੱਚ ਬੱਚੇ ਬੁੱਢੇ ਜਵਾਨ ਸਾਰੇ ਤਰ੍ਹਾਂ ਦੇ ਲੋਕ ਮਿਲ ਰਹੇ ਸਨ ਅਤੇ ਸਾਰੇ ਵਧੀਆ ਯਾਤਰਾ ਦਾ ਆਨੰਦ ਮਾਣ ਰਹੇ ਸਨ ਕਈ ਜਿਹੜੇ ਬਜ਼ੁਰਗ ਅਤੇ ਬੱਚੇ ਨਹੀਂ ਤੁਰ ਸਕਦੇ ਸਨ ਉਹਨਾਂ ਨੂੰ ਖੱਚਰਾ ਰਾਹੀਂ ਉੱਪਰ ਲਿਜਾਇਆ ਜਾ ਰਿਹਾ ਸੀ ਤਕਰੀਬਨ ਸਾਡੀ ਇਹ ਯਾਤਰਾ ਬਹੁਤ ਵਧੀਆ ਰਹੀ